ਜਿਵੇਂ ਕਿ ਸਾਡੇ ਪਿੰਡ ਖੇਤਰ ਦੇ ਵਿੱਚ ਪ੍ਰਾਈਵੇਟ ਹੋਸਪੀਟਲ ਨਹੀਂ ਹੈਗੇ ਜਿਵੇਂ ਕਿ ਉਹ ਸਾਥੋਂ ਵੀਹ ਵੀਹ ਕਿਲੋਮੀਟਰ ਦੂਰ ਨੇ ਜਿਵੇਂ ਕਿ ਰਾਜਪੁਰਾ ਹੋ ਗਿਆ ਜਾਂ ਪਟਿਆਲਾ ਜਾਂ ਫਤਿਹਗੜ੍ਹ ਅਤੇ ਸਾਨੂੰ ਪੇਂਡੂ ਵਾਲਿਆਂ ਪਿੰਡ ਵਾਲਿਆਂ ਨੂੰ ਉੱਥੇ ਤੱਕ ਪਹੁੰਚਣ ਨੂੰ ਬਹੁਤ ਦਿੱਕਤਬਾਜ਼ੀ ਆਉਂਦੀ ਹੈ ਜੇ ਅਸੀਂ ਉਹਨਾਂ ਹਸਪਤਾਲਾਂ ਦੇ ਵਿੱਚ ਪਹੁੰਚ ਜਾਂਦੇ ਹਾਂ ਤਾਂ ਸਾਨੂੰ ਉਹਨਾਂ ਦੇ ਵਿੱਚ ਕੋਈ ਇੰਨੀ ਖ਼ਾਸ ਵਧੀਆ ਸੰਭਾਲ ਨਹੀਂ ਕੀਤੀ ਜਾਂਦੀ ਸਾਡੀ ਉਹ ਫਿਰ ਸਾਨੂੰ ਕਿਤੇ ਹੋਰ ਔਰ ਕਿਸੇ ਹੋਰ ਹਸਪਤਾਲ ਵਿੱਚ ਭੇਜ ਦਿੰਦੇ ਨੇ ਤਦ ਸਾਨੂੰ ਉੱਥੇ ਜਾ ਕੇ ਵੀ ਬਹੁਤ ਪਰੇਸ਼ਾਨੀਆਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਸਾਡੀ ਇੰਨੀ ਉਹ ਨਹੀਂ ਹੁੰਦੀ ਜਾਣ ਵਾਸਤੇ ਪੂਰੇ ਸਾਡੇ ਕੋਲ ਸਾਧਨ ਨਹੀਂ ਹੁੰਦੇ ਅਸੀਂ ਇਸ ਕਰਕੇ ਉੱਥੇ ਵੀ ਉਹ ਫਿਰ ਸਾਨੂੰ ਖੱਜਲ ਖ਼ੁਆਰੀ ਕਰੀ ਜਾਂਦੇ ਨੇ ਜਿਵੇਂ ਕਿ ਉੱਧਰ ਜਾਓ ਇੱਧਰ ਜਾਓ ਵੀ ਅਸੀਂ ਇਸ ਕਰਕੇ ਅਸੀਂ ਜ਼ਿਆਦਾ ਹੀ ਉਲਝ ਜਾਂਦੇ ਹਾਂ